ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਮੈਂ ਰਵਿੰਦਰ ਗੱਲ ਕਰ ਰਿਹਾ ਜੀ ਮੈਂ ਇੱਕ ਫਾਰਮਰ ਹਾਂ ਅਤੇ ਹਾਂਜੀ ਅਤੇ ਮੈਂ ਇੱਥੇ ਮੇਰੇ ਕੋਲ ਸੱਤ ਅੱਠ ਗਾਵਾਂ ਨੇ ਠੀਕ ਹੈ ਅਤੇ ਮੈਨੂੰ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੰਸਲਟ ਮੈਂ ਤੁਹਾਡੇ ਨਾਲ ਪੁੱਛਣਾ ਚਾਹੁੰਦਾ ਜਾਣਨਾ ਚਾਹੁੰਦਾ ਕਿ ਅਸੀਂ ਮਤਲਬ ਕਿ ਥੋੜ੍ਹੀ ਜਿਹੀ ਪ੍ਰੋਡਕਟੀਵਿਟੀ ਸਾਨੂੰ ਕਿੱਦਾਂ ਅਸੀਂ ਇੰਕਰੀਸ ਕਰ ਸਕਦੇ ਹਾਂ ਇਹਨਾਂ ਦੇ ਕਰੀਬ ਅੱਗੇ ਸਪਲਾਈ ਵਿਦ ਮਿਲਕ ਦਾ ਦੁੱਧ ਦਾ ਕਰਨਾ ਪੈਂਦਾ ਇਹਨਾਂ ਦੀ ਹੈਲਥ ਵੀ ਸਹੀ ਨਹੀਂ ਰਹਿੰਦੀ ਇਹਨਾਂ ਦੀ ਹੈ ਨਾ ਅਤੇ ਅਸੀਂ ਔਰ ਕਿੱਦਾਂ ਅਸੀਂ ਇਹਨੂੰ ਇੰਪਰੂਵ ਕਰ ਸਕਦੇ ਹਾਂ ਤੁਹਾਡੀ ਸਲਾਹ ਚਾਹੀਦੀ ਸੀ ਤੁਹਾਡੀ ਮੈਮ ਤੁਹਾਡਾ ਨੰਬਰ ਮੈਨੂੰ ਤੁਹਾਡਾ ਨੰਬਰ ਮਿਲਿਆ ਸੀਗਾ ਗੁਲਜ ਗੁਰਜੀਤ ਭਾਅ ਜੀ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਉਹ ਤੁਹਾਡੇ ਤੋਂ ਪਹਿਲੇ ਵੀ ਕੰਸਲਟ ਕਰ ਚੁੱਕੇ ਨੇ ਅਤੇ ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ ਜੀ ਕਿ ਮੈਡਮ ਨਾਲ ਗੱਲ ਕਰਕੇ ਅਸੀਂ ਜਿੱਦਾਂ ਜਿਹੜੇ ਗਾਵਾਂ ਨੇ ਉਹਨਾਂ ਦੀ ਹੈਲਥ ਕਿੱਦਾਂ ਸਹੀ ਰੱਖ ਸਕਦੇ ਹਾਂ ਕਿਹੜੇ ਚੀਜ਼ਾਂ ਅਸੀਂ ਇਹਨਾਂ ਨੂੰ ਦੇਈਏ ਇਹ ਥੋੜ੍ਹਾ ਜਿਹਾ ਤੁਹਾਡਾ ਮੈਨੂੰ ਤੁਹਾਡੇ ਤੋਂ ਹੋਰ ਮਿਲ ਜਾਏ ਮੈਨੂੰ ਸੋਲੂਸ਼ਨ ਤਾਂ ਬਹੁਤ ਵਧੀਆ ਹੋਏਗਾ ਮੈਮ ਠੀਕ ਹੈ

ਠੀਕ ਹੈ ਜੀ ਠੀਕ ਹੈ

ਬਿਲਕੁਲ ਬਿਲਕੁਲ ਨਹੀਂ ਮੈਮ ਪਾਣੀ ਤਾਂ ਅਸੀਂ ਪੂਰੀ ਮਾਤਰਾ 'ਚ ਦੇ ਰਹੇ ਹਾਂ ਸਾਡੇ ਕੋਲ ਸੱਤ ਅੱਠ ਮੱਝਾਂ ਨੇ ਅਤੇ ਗਾਵਾਂ ਵੀ ਨੇ ਅਤੇ ਅਸੀਂ ਬਸ ਐਤਕੀਂ ਨਾ ਕਿਉਂਕਿ ਹੈਲਥ ਜਿਹੀ ਨਾ ਵਿਚਕਾਰ ਨਾ ਇੱਕ ਦੋ ਵੇਲੇ ਵਿਚਕਾਰ ਗਾਵਾਂ ਜਿਹੜੀ ਸੀਗੀਆਂ ਬੜੀਆਂ ਸਿੱਕ ਹੋ ਗਈਆਂ ਸੀਗੀਆਂ ਬਹੁਤ ਬਿਮਾਰ ਹੋ ਗਈਆਂ ਸੀਗੀਆਂ

ਅੱਛਾ ਜੀ ਠੀਕ ਹੈ ਜੀ ਮੈਮ ਮੈਂ ਜ਼ਰੂਰ ਧਿਆਨ ਰੱਖਾਂਗਾ ਇਸ ਚੀਜ਼ ਦਾ ਅਤੇ ਤੁਸੀਂ ਤੁਹਾਡਾ ਜਿੱਦਾਂ ਅਸੀਂ ਜੋ ਅ ਦੱਸੇ ਨੇ ਮੈਨੂੰ ਜਿਹੜੀ ਸਮਾਨ ਜਿਹੜਾ ਸੀ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਫੀਡ ਕਰਵਾਉਣ ਲਈ ਉਹ ਕਿੱਥੋਂ ਅਵੇਲੇਵਲ ਹੋਣਗੇ ਆਨਲਾਈਨ ਮੰਗਵਾਉਣੇ ਪੈਣਗੇ ਤੁਹਾਡੀ ਸ਼ੋਪ ਤੋਂ ਲੈ ਕੇ ਆਉਣੇ ਪੈਣੇ ਸਾਨੂੰ

ਠੀਕ ਹੈ ਜੀ ਮੈਮ ਠੀਕ ਹੈ ਜੀ ਮੈਮ ਮੈਂ ਫਿਰ ਦੇਖਦਾ ਗੱਲ ਕਰਦਾ ਠੀਕ ਹੈ ਜੀ ਠੀਕ ਹੈ ਮੈਮ ਜੀ ਥੈਂਕ ਯੂ ਜੀ ਥੈਂਕ ਯੂ